ਹਾਂਜੀ ਜੇ ਲਿਖਣ ਦੀ ਗੱਲ ਕੀਤੀ ਜਾਵੇ ਤਾਂ ਲਿਖਣ ਦਾ ਤਰੀਕਾ ਲਿਖਣ ਦਾ ਤਰੀਕਾ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਹ ਇਹ ਆਪਣਾ ਇੱਕ ਨਿੱਜੀ ਨਿੱਜੀ ਤਰੀਕਾ ਲਿਖਣ ਦਾ ਕਿਸੇ ਬੰਦੇ ਦਾ ਤਰੀਕਾ ਕਿਸੇ ਵੀ ਬੰਦੇ ਨਾਲ ਮੇਲ ਨਹੀਂ ਖਾਂਦਾ ਮੈਂ ਸਮਝਦਾ ਵੀ ਕੁਛ ਬੰਦੇ ਹੁੰਦੇ ਨੇ ਜੋ ਇੱਕ ਪ੍ਰੋਪਰ ਕੁਦਰਤ ਸਮਾਜ ਸੱਭਿਆਚਾਰ ਸਰਕਾਰ ਜਾਂ ਮੁੱਦੇ ਭਾਵਨਾ 'ਤੇ ਲਿਖਦੇ ਨੇ ਪਰ ਜੇ ਮੈਂ ਆਪਣੀ ਨਿ ਪਰਸਨਲੀ ਗੱਲ ਕਰਾਂ ਤਾਂ ਮੈਨੂੰ ਜੋ ਮੇਰੇ ਵਿਚਾਰ ਨੇ ਜੋ ਮੇਰੀਆਂ ਭਾਵਨਾਵਾਂ ਨੇ ਜਾਂ ਜੋ ਮੇਰੇ ਅਹਿਸਾਸ ਨੇ ਉਹ ਮੇਰੇ ਖੁਦ ਦੇ ਨੇ ਮੈਨੂੰ ਲਿਖਣ ਲਈ ਕਿਸੇ ਵੀ ਨਿਯਮਤ ਟਾਈਮ ਦੀ ਜਾਂ ਕਿਸੇ ਵੀ ਨਿਸ਼ਚਿਤ ਜਗ੍ਹਾ ਦੀ ਨਿਸ਼ਚਿਤ ਟਾਈਮ ਦੀ ਜਾਂ ਨਿਸ਼ਚਿਤ ਸਥਾਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਆਪਣੇ ਆਪ ਹੀ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਕਹਿ ਦਿੰਦੇ ਆਮਦ ਹੈ ਨਾ ਆਪਣੇ ਆਪ ਹੀ ਲਿਖਿਆ ਜਾਂਦਾ ਜਦੋਂ ਕੋਈ ਵੀ ਵਿਚਾਰ ਆਉਂਦਾ ਦਿਮਾਗ ਦੇ ਵਿੱਚ ਜਾਂ ਮੇਰੇ ਅਹਿਸਾਸ ਆਪਣੇ ਆਪ ਹੀ ਲਿਖਿਆ ਜਾਂਦਾ ਅਤੇ ਮੈਂ ਬੰਨ ਕੇ ਆਪਣੇ ਆਪ ਨੂੰ ਜਾਂ ਆਪਣੇ ਆਪ ਨੂੰ ਕਨਵੈਂਸ ਕਰਕੇ ਆਪਣੇ ਆਪ ਤੋਂ ਕੁਝ ਨਹੀਂ ਲਿਖਵਾ ਸਕਦਾ ਇਹ ਇੱਕ ਤਰ੍ਹਾਂ ਦਾ ਕੁਦਰਤੀ ਹੀ ਵਰਤਾਰਾ ਹੈਗਾ ਅਤੇ ਜੋ ਮੇਰੇ ਜਜ਼ਬਾਤ ਨੇ ਅਹਿਸਾਸ ਨੇ ਜੋ ਮੇਰੀਆਂ ਭਾਵਨਾਵਾਂ ਨੇ ਹੂ ਬ ਹੂ ਉਹ ਮੇਰੀਆਂ ਕਵਿਤਾਵਾਂ ਦੇ ਨਾਲ ਮੇਰੇ ਸ਼ਬਦਾਂ ਦੇ ਨਾਲ ਮੇਰੀ ਕਲਮ ਦੇ ਨਾਲ ਮੇਲ ਖਾਂਦੀਆਂ ਨੇ ਮੇਰੇ ਤੋਂ ਆਪਣੇ ਅਹਿਸਾਸਾਂ ਭਾਵਨਾਵਾਂ ਜਜ਼ਬਾਤਾਂ ਤੋਂ ਬਾਗੀ ਹੋ ਕੇ ਮੇਰੇ ਲਈ ਲਿਖਣਾ ਬਹੁਤ ਔਖਾ ਜੋ ਮੇਰੀ ਕਲਮ ਸ਼ਬਦ ਸ਼ਬਦਾਂ ਨੂੰ ਘੜਦੀ ਆ ਲਿਖਦੀ ਆ ਉਹ ਸਿਰਫ਼ ਰਿਐਲਿਟੀ ਦੇ ਨਾਲ ਵਾਸਤਵਿਕਤਾ ਦੇ ਨਾਲ ਮੇਲ ਖਾਂਦੇ ਨੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਲਪਨਿਕ ਦ੍ਰਿਸ਼ ਨਹੀਂ ਹੋਊਗਾ ਜੋ ਘਟਨਾ ਕਰਮ ਵਾਪਰਿਆ ਉਹਦੇ ਨਾਲ ਹੀ ਸੰਬੰਧਿਤ ਹੋਊਗੀ ਅਤੇ ਇਹ ਇਹ ਤਰਾਸਗੀ ਆ ਜਾਂ ਕਹਿ ਲਓ ਇੱਕ ਤਰ੍ਹਾਂ ਦੀ ਕਿਤੇ ਨਾ ਕਿਤੇ ਖੁਦਗਰਜੀ ਵੀ ਆ ਵੀ ਮੈਂ ਜੋ ਕੁਛ ਵੀ ਲਿਖਦਾਂਗਾ ਜੋ ਰਿਐਲਿਟੀ ਹੈ ਜੋ ਮੇਰੇ ਨਾਲ ਵਾਪਰਦਾ ਜਾਂ ਮੇਰਾ ਹੈ ਜੋ ਵੀ ਉਹਦੇ ਬਾਰੇ ਹੀ ਲਿਖਦਾ ਮੇਰੇ ਤੋਂ ਜੋ ਬਾਹਰੀ ਕੁਦਰਤ ਸਮਾਜ ਆ ਜਾਂ ਸੱਭਿਆਚਾਰ ਆ ਜਾਂ ਮੁੱਦੇ ਨੇ ਜਾਂ ਭਾਵਨਾਵਾਂ ਨੇ ਉਹਨਾਂ ਦੇ ਬਾਰੇ ਮੈ ਮੈਨੂੰ ਲਿਖਣਾ ਥੋੜ੍ਹਾ ਜਿਹਾ ਔਖਾ ਲੱਗਦਾ ਜੋ ਮੇਰੇ ਦਿਮਾਗ ਦਾ ਜ਼ਿਆਦਾਤਰ ਮੈਂ ਜੋ ਵੀ ਮੇਰੇ ਦਿਮਾਗ ਦਾ ਅੰਦਰ ਚੱਲਦਾ ਹੈਗਾ ਹੈ ਨਾ ਮੈਂ ਉਹਦੇ ਬਾਰੇ ਹੀ ਲਿਖਣਾ ਜ਼ਿਆਦਾ ਪਸੰਦ ਕਰਦਾ ਅਤੇ ਉਹ ਹੀ ਹੀ ਲਿਖਦਾ ਹਾਂ ਜੇ ਇੱਕ ਤਰੀਕੇ ਨਾਲ ਕਿਹਾ ਜਾਵੇ ਤਾਂ ਜੋ ਮੇਰੇ ਸ਼ਬਦ ਨੇ ਉਹ ਹੂ ਬ ਹੂ ਮੇਰੀਆਂ ਅਹਿਸਾਸ ਮੇਰੇ ਭਾਵਨਾਵਾਂ ਜੋ ਮੇਰੇ 'ਤੇ ਵਾਪਰ ਰਿਹਾ ਜਾਂ ਜੋ ਜੋ ਫੀਲ ਹੋ ਰਿਹਾ ਉਹਨਾਂ ਦੇ ਇੱਕ ਤਰ੍ਹਾਂ ਦੀ ਕਲਰ ਕਾਪੀ ਹੁੰਦੀਆਂ